ਮੈਂ ਆਪਣੇ ਰੋਜ਼ਾਨਾ ਸੁਬਹਾ ਦੇ ਵਰਕਆਊਟ ਵਿੱਚ ਵਿਕਲਪ ਵਰਕਆਊਟ ਦੀ ਵੀ ਬਹੁਤ ਕੋਸ਼ਿਸ਼ ਕਰਦਾ ਹਾਂ ਜਿਵੇਂ ਕਿ ਸਾਈਕਲਿੰਗ ਕਰਨਾ ਕਿਉਂਕੀ ਸਾਈਕਲਿੰਗ ਕਰਨ ਦੇ ਨਾਲ ਸਾਡੀਆਂ ਲੱਤਾਂ ਦੇ ਵਿੱਚ ਜੋ ਮਾਸਪੇਸ਼ੀਆਂ ਹੁੰਦੀਆਂ ਹਨ ਉਹਨਾਂ ਦੀ ਕਸਰਤ ਹੋ ਜਾਂਦੀਆਂ ਹਨ ਅਤੇ ਉਹ ਖੁੱਲ ਜਾਂਦੀਆਂ ਹਨ ਸਾਈਕਲਿੰਗ ਕਰਨ ਦੇ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਫਿਟ ਰਹਿੰਦਾ ਹੈ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਬਹੁਤ ਐਸੇ ਬਜ਼ੁਰਗ ਹਨ ਜੋ ਕਿ ਰੋਜ਼ਾਨਾ ਸਾਈਕਲ ਰਾਹੀਂ ਵਰਕਾਊਟ ਕਰਦੇ ਹਨ ਅਤੇ ਮੈਂ ਵੀ ਕਰਦਾ ਹਾਂ ਮੈਂ ਜ਼ਿਆਦਾਤਰ ਦੌੜਨ ਦੌੜਦਾ ਹਾਂ ਅਤੇ ਸਾਈਕਲ ਵਰਕਆਊਟ ਦੀ ਵੀ ਕੋਸ਼ਿਸ਼ ਕਰਦਾ ਹਾਂ ਮੈਂ ਸਪ੍ਰਿੰਟ ਅੰਤਰਾਲ ਵਿੱਚ ਵੀ ਭਾਗ ਲਿੱਤਾ ਹੈ ਅਤੇ ਸਪ੍ਰਿੰ ਦਾ ਸਪ੍ਰਿੰਟ ਵੀ ਮਾਰਦਾ ਹਾਂ ਜਿਵੇਂ ਸੌ ਸੌ ਮੀਟਰ ਦੀਆਂ ਦੋ ਸੌ ਮੀਟਰ ਦੀਆਂ ਸਪ੍ਰਿੰਟਾਂ ਆਦਿ ਵੀ ਲਾਉਂਦਾ ਹਾਂ ਦੌੜਨ ਨੇ ਮੈਨੂੰ ਤੰਦਦੁ ਤੰਦਰੁਸਤ ਰਹਿਣ ਵਿੱਚ ਬਹੁਤ ਹੀ ਮਦਦ ਕੀਤੀ ਹੈ ਕਿਉਂਕਿ ਦੌੜਨ ਨਾਲ ਸਾਡੀਆਂ ਲੱਤਾਂ ਦੀ ਐਕਸਰਸਾਈਜ਼ ਹੁੰਦੀ ਹੈ ਸਾਡਾ ਸਾਹ ਪੱਕਦਾ ਹੈ ਅਤੇ ਅਸੀਂ ਕਦੇ ਵੀ ਬਿਮਾਰ ਨਹੀਂ ਹੁੰਦੇ ਸਾਨੂੰ ਸੁਬਹਾ ਰੋਜ਼ਾਨਾ ਸੈਰ ਜਾਂ ਰਨਿੰਗ ਜਾਂ ਸਾਈਕਲਿੰਗ ਕਰਨੀ ਚਾਹੀਦੀ ਹੈ ਇਸ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਕਦੇ ਵੀ ਬਿਮਾਰ ਨਹੀਂ ਹੁੰਦਾ ਅਤੇ ਸਾਨੂੰ ਕੋਈ ਬਿਮਾਰੀ ਨਹੀਂ ਲੱਗਦੀ ਅਤੇ ਅਸੀਂ ਫਿੱਟ ਅਤੇ ਤੰਦਰੁਸਤ ਰਹਿੰਦੇ ਹਾਂ ਮੇਰੀ ਰਨਿੰਗ ਅਤੇ ਸਾਈਕਲਿੰਗ ਤੰਦਰੁਸਤ ਰਹਿਣ ਵਿੱਚ ਬਹੁਤ ਹੀ ਮਦਦ ਕੀਤੀ ਹੈ ਕਿਉਂਕਿ ਦੌੜਨ ਨਾਲ ਸਾਡੀਆਂ ਲੱਤਾਂ ਕਦੇ ਥਕਾਵਟ ਮਹਿਸੂਸ ਨਹੀਂ ਕਰਦੀਆਂ ਸਾਨੂੰ ਰੋਜ਼ਾਨਾ ਦੌੜਨਾ ਚਾਹੀਦਾ ਹੈ ਅਤੇ ਸਾਈਕਲਿੰਗ ਵੀ ਕਰਨੀ ਚਾਹੀਦੀ ਹੈ